ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਕਿ ਮੇਰੇ ਬਹੁਤ ਜ਼ਿਆਦਾ ਮਨਪਸੰਦ ਨੇ ਕਿਤਾਬ ਲੜੀ ਦੀ ਗੱਲ ਕਰੀ ਜਾਵੇ ਤਾਂ ਮੇਰੇ ਕੋਲ ਇੱਦਾਂ ਦੀ ਕਿਤਾਬ ਹੈ ਜਿਹਦੀਆਂ ਪੰਜ ਦਸ ਭਾਗ ਨੇ ਅਤੇ ਉਹ ਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾ ਜੀ ਤੱਕ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਮਤਲਬ ਕਿ ਸਿੱਖ ਧਰਮ ਦੀ ਸਥਾਪਨਾ ਕੀਤੀ ਸੀਗੀ ਉਸ ਤੋਂ ਲੈ ਕੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੱਕ ਮਤਲਬ ਕਿ ਗਿਆਰ੍ਹਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਅਤੇ ਉਹਨਾਂ ਸਾਹਮਣੇ ਮੱਥਾ ਟੇਕਿਆ ਸੀਗਾ ਅਤੇ ਇਹਦੇ ਵਿੱਚ ਮੈਨੂੰ ਪਤਾ ਲੱਗਦਾ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਲੋਕਾਂ ਨੂੰ ਸਿੱਧੇ ਰਾਹੀਂ ਪਾਇਆ ਸੀਗਾ ਕਿਵੇਂ ਚਾਰ ਉਦਾਸੀਆਂ ਕੀਤੀਆਂ ਸੀਗੀਆਂ ਅਤੇ ਬਹੁਤ ਸਾਰੀਆਂ ਗੱਲਾਂ ਦਾ ਮੈਨੂੰ ਸਿੱਖਣ ਨੂੰ ਮਿਲਦੀਆਂ ਨੇ ਅਤੇ ਕਿਵੇਂ ਗੁਰਬਾਣੀ ਨੂੰ ਪੜ੍ਹਨਾ ਹੈ ਹੋਰ ਕਿੰਨੀਆਂ ਵੀ ਨੌਲੇਜ ਵਾਲੀਆਂ ਗੱਲਾਂ ਨੇ ਉਹ ਸਾਰੀਆਂ ਮੈਨੂੰ ਉਹਨਾਂ ਕਿਤਾਬਾਂ ਤੋਂ ਪਤਾ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਲੱਗਦਾ ਹੈ ਕਿਵੇਂ ਉਹਨਾਂ ਨੇ ਮਤਲਬ ਕਿ ਸਿੱਖ ਧਰਮ ਲਈ ਸਾਰਾ ਸਰਬੰਸ ਆਪਣਾ ਵਾਰ ਦਿੱਤਾ ਸੀ